ਪੰਜਾਬ ਦੀਆਂ ਮੁੱਖ ਫਸਲਾਂ ਹਨ ਚਾਵਲ ਕਣਕ ਮੱਕੀ ਕਪਾਹ ਪੰਜਾਬ ਹਮੇਸ਼ਾ ਤੋਂ ਹੀ ਆਪਣੇ ਕਿਸਾਨਾਂ ਲਈ ਜਾਣਿਆ ਜਾਂਦਾ ਹੈ ਕਿਸਾਨ ਖੇਤ ਸਰੋਂ ਪੰਜਾਬ ਦੀ ਮੁੱਖ ਪਹਿਚਾਣ ਹੈ ਪੰਜਾਬ ਆਪਣੇ ਖੇਤੀਬਾੜੀ ਦੇ ਕਰਕੇ ਹੀ ਅੱਜ ਦੇਸ਼ ਦੇ ਵਿੱਚ ਬਹੁਤ ਇੱਜਤ ਭਰਿਆ ਰਾਜ ਮੰਨਿਆ ਜਾਂਦਾ ਹੈ ਪੰਜਾਬ ਦੀ ਰੈਵਨਿਊ ਖੇਤੀਬਾੜੀ ਦੇ ਸਿਰ 'ਤੇ ਹੀ ਹੈ ਜ਼ਿਆਦਾਤਰ ਅਤੇ ਪੰਜਾਬ ਦੇ ਪਿੰਡਾਂ ਵਿੱਚ ਪਸ਼ੂ ਵੀ ਪਾਏ ਜਾਂਦੇ ਹਨ ਜਿਵੇਂ ਕਿ ਗਾਂ ਘੋੜੇ ਕੁੱਕੜ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਪਿੰਡਾਂ ਵਿੱਚ ਅੱਜ ਵੀ ਲੋਕ ਕੁੱਕੜ ਦੀ ਆਵਾਜ਼ ਨਾਲ ਹੀ ਸਵੇਰੇ ਉੱਠਦੇ ਹਨ ਅਤੇ ਰਾਤ ਪੈਣ 'ਤੇ ਟਾਈਮ ਨਾਲ ਸੋ ਜਾਂਦੇ ਹਨ ਉੱਥੇ ਅਲਾਰਮ ਲਈ ਘੜੀਆਂ ਦੀ ਵਰਤੋਂ ਨਹੀਂ ਕਰਦੇ ਪਿੰਡ ਵਿੱਚ ਬਹੁਤ ਵਧੀਆ ਪਸ਼ੂ ਫਸਲਾਂ ਦੇਖਣ ਨੂੰ ਮਿਲਦੀਆਂ ਹਨ ਧੰਨਵਾਦ